ਹੈਲੋ ਸਤਿ ਸ਼੍ਰੀ ਅਕਾਲ ਮੈਮ ਕਿਵੇਂ ਹੋ ਬਸ ਮੈਮ ਵਧੀਆ ਮੈਮ ਵਧੀਆ ਬਸ ਤੁਸੀਂ ਦੱਸੋ ਕਿਵੇਂ ਆ ਘਰ ਦੇ ਸਾਰੇ ਅੱਛਾ ਮੈਮ ਹੋਰ ਸਕੂਲ ਦਾ ਕਿਵੇਂ ਵਧੀਆ ਹਾਂਜੀ ਮੈਮ ਹਾਂਜੀ ਹਾਂਜੀ ਮੈਂ ਵੀ ਸੁਣਿਆ ਸੀਗਾ ਹਾਂਜੀ ਮੈਮ ਸਹੀ ਗੱਲ ਹੈ ਬਿਲਕੁਲ ਅੱਛਾ ਮੈਮ ਹੋਰ ਮੈਮ ਬਸ ਮੈਮ ਵਧੀਆ ਮੇਰੇ ਕਲਾਸ ਦੇ ਬੱਚੇ ਆ ਵੈਸੇ ਸਾਰੇ ਵਧੀਆ ਹੀ ਪੜ੍ਹਦੇ ਆ ਪਰ ਬੱਚੇ ਬਾਰੇ ਗੱਲ ਕਰਨੀ ਸੀਗੀ ਇਕ ਮੈਮ ਪ੍ਰਥਮ ਨਾਮ ਦਾ ਹੈਗਾ ਨਾ ਬੱਚਾ ਹਾਂਜੀ ਮੈਮ ਮੈਮ ਅਤੇ ਉਹ ਬੱਚਾ ਨਾ ਪੜ੍ਹਾਈ ਵਿੱਚ ਬਹੁਤ ਜ਼ਿਆਦਾ ਵੀਕ ਹੈ ਹਾਂਜੀ ਮੈਂ ਨਾ ਉਹਦੇ ਬਾਰੇ ਤੁਹਾਨੂੰ ਪੁੱਛਣਾ ਸੀਗਾ ਕਿ ਉਹ ਮਤਲਬ ਜਿਵੇਂ ਮੇਰਾ ਸਬਜੈਕਟ ਤੁਹਾਨੂੰ ਪੰਜਾਬੀ ਹੈ ਨਾ ਅਤੇ ਮੈਂ ਇਹ ਪੁੱਛਣਾ ਚਾਹ ਰਹੀ ਸੀ ਕਿ ਉਹ ਮੇਰੇ ਸਬਜੈਕਟ 'ਚੋਂ ਹੀ ਵੀਕ ਹੈ ਕਿ ਹੋਰਾਂ 'ਚ ਵੀ ਹੈਗਾ ਹਾਂਜੀ ਮੈਮ ਮੈਂ ਵੀ ਉਹੀ ਕਹਿ ਰਹੀ ਸੀਗੀ ਕਿ ਕੁਝ ਜ਼ਿਆਦਾ ਹੀ ਵੀਕ ਹੈ ਇਹਦੀ ਪਰਫੋਰਮੈਂਸ ਬਹੁਤ ਡਾਊਨ ਜਾ ਰਹੀ ਹੈ ਹਾਂਜੀ ਮੈਮ ਇਹਦੇ ਮਤਲਬ ਕਿਵੇਂ ਘਰੇ ਸਭ ਸਹੀ ਹੈ ਕਿਵੇਂ ਕੋਈ ਬੱਚਾ ਟੈਨਸ਼ਨ ਵਿੱਚ ਤਾਂ ਨਹੀਂ ਹੈਗਾ ਹਾਂਜੀ ਹਾਂਜੀ ਮੈਮ ਬਿਲਕੁਲ ਸਹੀ ਹੈ ਇਹ ਤਾਂ

ਮੈਮ ਇੱਦਾਂ ਤਾਂ ਫੇਰ ਆਪਾਂ ਕੋਈ ਸਲਿਊਸ਼ਨ ਕੱਢਣਾ ਪੈਣਾ ਬੱਚੇ ਦਾ ਇਸ ਤਰ੍ਹਾਂ ਦਾ ਕੰਮ ਨਹੀਂ ਚੱਲ ਸਕਦਾ ਹੈਗਾ ਹਾਂਜੀ ਹਾਂਜੀ ਮੈਮ ਬਿਲਕੁਲ ਸਹੀ ਗੱਲ ਹੈ ਮੈਂ ਵੀ ਉਹ ਕਹਿ ਰਹੀ ਸੀਗੀ ਕਿ ਬੱਚੇ ਨੂੰ ਥੋੜ੍ਹਾ ਪਿਆਰ ਨਾਲ ਸਮਝਾਈਏ ਆਪਾਂ ਵੀ ਅਤੇ ਥੋੜ੍ਹਾ ਇਹਦੇ 'ਤੇ ਟਾਈਮ ਜ਼ਿਆਦਾ ਲਗਾਈਏ ਹਾਂਜੀ ਮੈਮ ਅਤੇ ਨਾਲੇ ਮੈਮ ਬੱਚੇ ਨੂੰ ਵੀ ਥੋੜ੍ਹਾ ਸਮਝਾਉਣਾ ਪੈਣਾ ਕਿ ਉਹ ਹੋਰਾਂ ਬੱਚਿਆਂ ਨਾਲ ਥੋੜ੍ਹਾ ਮਿਲੇ ਜੁਲੇ ਹੈ ਨਾ ਇਕੱਲਾ ਇਕੱਲਾ ਨਾ ਹੋਵੇ ਕਿ ਇਹਦੇ ਮਾਨਸਿਕ ਸਥਿਤੀ ਉੱਤੇ ਵੀ ਕੁਝ ਅਸਰ ਨਾ ਹੋਵੇ ਬੱਚੇ 'ਤੇ ਹਾਂਜੀ ਮੈਮ ਚਲੋ ਮੈਮ ਹਾਂਜੀ ਹਾਂਜੀ ਮੈਮ ਚਲੋ ਮੈਮ ਕੱਲ੍ਹ ਕਰਾਂਗੇ ਫਿਰ ਸਟਾਰਟਿੰਗ 'ਚ ਗੱਲ ਓਕੇ ਮੈਮ ਸਤਿ ਸ਼੍ਰੀ ਅਕਾਲ